ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੀਆਂ ਛੁੱਟੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਮੈਨੂੰ ਆਰਾਮਦਾਇਕ ਲੱਗਦੀਆਂ ਨੇ ਅਤੇ ਉਹ ਮੈਨੂੰ ਇੰਨੀਆਂ ਤਰੋਤਾਜ਼ਾ ਕਿਉਂ ਲੱਗਦੀਆਂ ਨੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਮੈਨੂੰ ਜਿਹੜੀਆਂ ਗਰਮੀਆਂ ਵਿੱਚ ਜੂਨ ਜੁਲਾਈ ਦੀਆਂ ਛੁੱਟੀਆਂ ਹੁੰਦੀਆਂ ਵਾ ਠੀਕ ਹੈ ਉਹ ਮੈਨੂੰ ਬਹੁਤ ਵਧੀਆ ਲੱਗਦੀਆਂ ਵਾ ਕਿਉਂਕਿ ਇੱਕ ਕਾਰਨ ਵੇਖੋ ਉਹਦਾ ਪਹਿਲਾਂ ਤਾਂ ਇਹਨਾਂ ਛੁੱਟੀਆਂ ਵਿੱਚ ਗਰਮੀ ਬਹੁਤ ਹੁੰਦੀ ਠੀਕ ਏ ਅਤੇ ਜਦੋਂ ਆਪਾਂ ਘਰੋਂ ਬਾਹਰ ਜਾਂਦੇ ਹਾਂ ਜਾ ਕੇ ਕੋਈ ਕੰਮ ਕਰਦੇ ਹਾਂ ਹੈ ਨਾ ਜੋਬ ਕਰਦੇ ਹਾਂ ਅਤੇ ਉਦੋਂ ਇੰਨੀ ਗਰਮੀ ਵਿੱਚ ਕੰਮ ਕਰਨਾ ਵੀ ਔਖਾ ਲੱਗਦਾ ਵਾ ਅਤੇ ਇਹਨਾਂ ਛੁੱਟੀਆਂ ਨੂੰ ਜਦੋਂ ਅਸੀਂ ਘਰੋਂ ਆਪਣੇ ਘਰ ਬਹਿ ਕੇ ਆਰਾਮ ਨਾਲ਼ ਬਿਤਾਉਂਦੇ ਹਾਂ ਠੀਕ ਹੈ ਪੱਖਿਆਂ ਥੱਲੇ ਕੂਲਰਾਂ ਥੱਲੇ ਏਸੀਆਂ ਥੱਲੇ ਅਤੇ ਫਿਰ ਸਾਨੂੰ ਬੜੀਆਂ ਮਤਲਬ ਕਿ ਆਰਾਮਦਾਇਕ ਲੱਗਦੀਆਂ ਵਾ ਬਾਹਰ ਜ਼ਿਆਦਾ ਧੁੱਪ ਵਿੱਚ ਜਾ ਕੇ ਬਿਮਾਰ ਹੋਣ ਦਾ ਖਤਰਾ ਨਹੀਂ ਰਹਿੰਦਾ ਅਤੇ ਸਭ ਤੋਂ ਮਤਲਬ ਕਿ ਫਿਰ ਬੰਦਾ ਸਾਰਾ ਦਿਨ ਆਰਾਮ ਨਾਲ਼ ਜਿਹੜਾ ਵਾ ਉਹ ਬੈਠ ਸਕਦਾ ਦੂਸਰੀ ਗੱਲ ਕਿ ਫਿਰ ਜਲਦੀ ਜਲਦੀ ਸਵੇਰੇ ਸਵੇਰੇ ਭੱਜਾ ਭਜਾਈ ਨਹੀਂ ਲੱਗਦੀ ਜਦੋਂ ਜੋਬ 'ਤੇ ਜਾਣਾ ਹੁੰਦਾ ਉਦੋਂ ਫਿਰ ਬਹੁਤ ਭੱਜਾ ਭਜਾਈ ਹੁੰਦੀ ਅਸੀਂ ਆਰਾਮ ਨਾਲ਼ ਉੱਠਦੇ ਹਾਂ ਆਪਣਾ ਨਹਾਉਂਦੇ ਧੋਂਦੇ ਹਾਂ ਆਪਣਾ ਕੰਮ ਕਰਦੇ ਹਾਂ ਠੀਕ ਹੈ ਅਤੇ ਫਿਰ ਆਰਾਮ ਨਾਲ਼ ਜਿਹੜਾ ਵਾ ਕੰਮ ਕਰਨ ਤੋਂ ਬਾਅਦ ਖਾਣਾ ਵਗੈਰਾ ਖਾਣ ਤੋਂ ਬਾਅਦ ਬਹਿੰਦੇ ਹਾਂ ਸੌਂਦੇ ਹਾਂ ਮੈਨੂੰ ਇਹ ਸਾਰਾ ਕੁਛ ਫਿਰ ਉਹਨਾਂ ਦਿਨਾਂ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਵਾ ਉਹ ਚੰਗਾ ਲੱਗਦਾ ਬੇਸ਼ੱਕ ਗਰਮੀ ਹੁੰਦੀ ਆ ਕੰਮ ਕਰਦੇ ਸਮੇਂ ਗਰਮੀ ਵੀ ਲੱਗਦੀ ਪਰ ਉਹ ਕੰਮ ਥੋੜ੍ਹੇ ਸਮੇਂ ਵਿੱਚ ਹੀ ਨਿਪਟਾ ਕੇ ਅਤੇ ਆਰਾਮ ਜਿਹੜਾ ਵਾ ਅਸੀਂ ਕਰ ਸਕਦੇ ਹਾਂ ਇਸ ਲਈ ਮੈਨੂੰ ਇਨ੍ਹਾਂ ਛੁੱਟੀਆਂ ਵਿੱਚ ਜਿਹੜਾ ਵਾ ਉਹ ਬਹੁਤ ਮਜ਼ਾ ਆਉਂਦਾ ਇਸ ਤੋਂ ਇਲਾਵਾ ਇਹ ਛੁੱਟੀਆਂ ਜ਼ਿਆਦਾ ਹੁੰਦੀਆਂ ਜੇ ਅਸੀਂ ਕਿਤੇ ਆਪਣੇ ਪਰਿਵਾਰ ਨਾਲ਼ ਘੁੰਮਣ ਜਾਣ ਦਾ ਪ੍ਰੋਗਰਾਮ ਵੀ ਬਣਾਉਂਦੇ ਹਾਂ ਤਾਂ ਉਹ ਵੀ ਆਰਾਮ ਨਾਲ਼ ਬਣ ਜਾਂਦਾ ਅਤੇ ਬਹੁਤ ਸਾਰੀਆਂ ਜਿਵੇਂ ਥਾਵਾਂ 'ਤੇ ਆਪਾਂ ਜਾ ਸਕਦੇ ਹਾਂ ਗਰਮੀਆਂ ਦੀਆਂ ਛੁੱਟੀਆਂ ਨੂੰ ਕੱਟਣ ਵਾਸਤੇ ਕਈ ਲੋਕ ਜਿਵੇਂ ਡਲਹੌਜ਼ੀ ਜਾਂਦੇ ਆ ਕਈ ਕਈ ਤਰ੍ਹਾਂ ਦੀਆਂ ਵਾਟਰ ਪਾਰਕਾਂ 'ਚ ਜਾਂਦੇ ਆ ਹੈ ਨਾ ਅਤੇ ਇੱਕ ਚੀਜ਼ ਇਹ ਵੇਖੋ ਜਦੋਂ ਆਪਾਂ ਫੈਮਿਲੀ ਟ੍ਰਿਪ ਬਣਾਉਂਦੇ ਹਾਂ ਅਤੇ ਅਸੀਂ ਮੌਸਮ ਦਾ ਵੀ ਧਿਆਨ ਰੱਖਦੇ ਹਾਂ ਜਦੋਂ ਅਸੀਂ ਸਰਦੀਆਂ 'ਚ ਕਿਤੇ ਜਾਂਦੇ ਹਾਂ ਅਤੇ ਸਾਨੂੰ ਕਿਤੇ ਜ਼ਿਆਦਾ ਸਰਦੀ ਜਾਂ ਕਿਤੇ ਫੋਗ ਦਾ ਸਾਹਮਣਾ ਕਰਨਾ ਪੈਂਦਾ ਜਿਹਨਾਂ ਕਰਕੇ ਜਿਹੜਾ ਰੋਡ ਆ ਉਹ ਚੰਗੀ ਤਰ੍ਹਾਂ ਦਿਖਦੇ ਨਹੀਂ ਆ ਅਤੇ ਉਹਨਾਂ ਕਰਕੇ ਕੀ ਹੁੰਦਾ ਕਿ ਧੁੰਦ ਦੇ ਕਾਰਨ ਕਈ ਤਰ੍ਹਾਂ ਨੁਕਸਾਨ ਹੋ ਜਾਂਦੇ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਬਿਲਕੁਲ ਵੀ ਸਾਹਮਣਾ ਨਹੀਂ ਕਰਨਾ ਪੈਂਦਾ ਉਹਨਾਂ ਦਾ ਕਿਉਂਕਿ ਰੋਡ ਜਿਹੜੇ ਆ ਉਹ ਬੇਸ਼ੱਕ ਆਵਾਜਾਈ ਜ਼ਿਆਦਾ ਹੋਵੇਗੀ ਪਰ ਜਿਹੜਾ ਵਾ ਮੌਸਮ ਸਾਫ਼ ਹੁੰਦਾ ਇਸ ਲਈ ਰੋਡ ਨੂੰ ਵੇਖਣ ਵਿੱਚ ਜਿਹੜੀ ਆ ਉਹ ਕੋਈ ਬਹੁਤੀ ਦਿੱਕਤ ਜਿਹੜੀ ਆ ਉਹ ਪੇਸ਼ ਨਹੀਂ ਆਉਂਦੀ ਅਤੇ ਦਿਨ ਵੀ ਵੱਡੇ ਹੁੰਦੇ ਆ ਆਰਾਮ ਨਾਲ਼ ਜਿਹੜਾ ਵਾ ਉਹ ਜ਼ਿਆਦਾ ਸਮਾਂ ਅਸੀਂ ਜਿਹੜਾ ਵਾ ਉਹ ਘੁੰਮ ਸਕਦੇ ਹਾਂ ਠੀਕ ਹੈ ਅਤੇ ਮੈਂ ਜਿਹੜਾ ਵਾ ਇਨ੍ਹਾਂ ਛੁੱਟੀਆਂ ਵਿੱਚ ਕਿਸੇ ਵੀ ਜ਼ਿਆਦਾ ਵੱਡੇ ਟ੍ਰਿਪ 'ਤੇ ਜਾ ਕੇ ਨਹੀਂ ਪਸੰਦ ਜਾਣਾ ਪਸੰਦ ਨਹੀਂ ਕਰਦੀ ਪਰ ਮੈਂ ਜਿਵੇਂ ਵੱਖ ਵੱਖ ਤਰ੍ਹਾਂ ਦੀਆਂ ਵਾਟਰ ਪਾਰਕਾਂ ਵਾ ਉੱਥੇ ਪਰਿਵਾਰ ਨਾਲ਼ ਜਾਣਾ ਵਾ ਜਿਹੜਾ ਵਾ ਚੰਗਾ ਲੱਗਦਾ ਮੈਨੂੰ ਕਿ ਅਸੀਂ ਆਪਣੇ ਪਰਿਵਾਰ ਸਮੇਤ ਇੱਕ ਦਿਨ ਦਾ ਉਹ ਟ੍ਰਿਪ ਹੁੰਦਾ ਵਾ ਸਵੇਰੇ ਤੜਕੇ ਜਾਓ ਸ਼ਾਮ ਨੂੰ ਜਿਹੜਾ ਤੁਸੀਂ ਆਪਣੇ ਘਰ ਆ ਜਾਂਦੇ ਜੇ ਅਤੇ ਉਹਦੇ ਵਿੱਚ ਵੀ ਖੂਬ ਇੰਜੋਏ ਵੀ ਕਰਦੇ ਜੇ ਖਾਂਦੇ ਪੀਂਦੇ ਵੀ ਜੇ ਮਸਤੀ ਵੀ ਕਰਦੇ ਇਸ ਲਈ ਮੈਨੂੰ ਜਿਹੜਾ ਵਾ ਉਹ ਗਰਮੀਆਂ ਵਿੱਚ ਇੱਕ ਦਿਨ ਦਾ ਟ੍ਰਿਪ ਜਿਵੇਂ ਆਪਾਂ ਕਿਤੇ ਵਾਟਰ ਪਾਰਕ ਵਿੱਚ ਜਾਂਦੇ ਹਾਂ ਉਹ ਮੈਨੂੰ ਜਿਹੜਾ ਵਾ ਉਹ ਪਸੰਦ ਹੈਗਾ ਵਾ ਅਤੇ ਉਸ ਵਿੱਚ ਮੈਂ ਆਪਣੇ ਪਰਿਵਾਰ ਸਮੇਤ ਜਾਣਾ ਜਿਹੜਾ ਵਾ ਉਹ ਪਸੰਦ ਕਰਦੀ ਹਾਂ ਅਤੇ ਬਹੁਤ ਖੁਸ਼ੀ ਵੀ ਮਤਲਬ ਉਸ ਸਮੇਂ ਮੈਨੂੰ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਮੈਂ ਜਿਹੜਾ ਵਾ ਤਰੋਤਾਜ਼ਾ ਮਹਿਸੂਸ ਕਰਦੀ ਹਾਂ ਠੀਕ ਹੈ ਜੀ ਧੰਨਵਾਦ